ਅਸਲ ਵਿੱਚ ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ ਮੈਨੂੰ ਨੇਚਰ ਦੀਆਂ ਤਸਵੀਰਾਂ ਲੈਣਾ ਬਹੁਤ ਪਸੰਦ ਹੈ ਅਸਲ ਵਿੱਚ ਮੈਂ ਜਦੋਂ ਨੇਚਰ ਵਿੱਚ ਰਹਿੰਦੀ ਹਾਂ ਤਾਂ ਮੈਂ ਆਪਣੇ ਆਪ ਨੂੰ ਰਲੈਕਸ ਫੀਲ ਕਰਦੀ ਹਾਂ ਮੈਨੂੰ ਨੇਚਰ ਵਿੱਚ ਜਾ ਕੇ ਫੋਟੋਆਂ ਲੈਣਾ ਬਹੁਤ ਪਸੰਦ ਹੈ ਜਿਵੇਂ ਕਿ ਅਲੱਗ ਅਲੱਗ ਬਾਰਡ ਵਗੈਰਾ ਪੰਛੀਆਂ ਦੀਆਂ ਵੀ ਤਸਵੀਰਾਂ ਲੈਣਾ ਮੈਨੂੰ ਬਹੁਤ ਪਸੰਦ ਹੈ ਪਹਾੜਾਂ ਵਿੱਚ ਜਾ ਕੇ ਮੈਨੂੰ ਪਹਾੜਾਂ ਵਿੱਚ ਜਾਣਾ ਬਹੁਤ ਪਸੰਦ ਆ ਉੱਥੇ ਪੇੜ ਪੌਦੇ ਵਗੈਰਾ ਮੈਨੂੰ ਇਹਨਾਂ ਚੀਜ਼ਾਂ ਦੀਆਂ ਵੀ ਤਸਵੀਰਾਂ ਲੈਣਾ ਬਹੁਤ ਪਸੰਦ ਹੈ ਜਦੋਂ ਪਹਾੜਾਂ ਵਿੱਚ ਮੀਂਹ ਪੈਂਦਾ ਹੈ ਤਾਂ ਉੱਥੋਂ ਦਾ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ ਤਾਂ ਮੈਨੂੰ ਉੱਥੋਂ ਦੀਆਂ ਵੀ ਤਸਵੀਰਾਂ ਲੈਣਾ ਬਹੁਤ ਪਸੰਦ ਹੈ ਅਸ ਫੋਟੋਗ੍ਰਾਫੀ ਨਾਲ ਇਹਨਾਂ ਚੀਜ਼ਾਂ ਦੀ ਮੇਰੇ ਕੋਲ ਇੱਕ ਯਾਦ ਰਹਿ ਜਾਂਦੀ ਹੈ ਵੀ ਮੈਂ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਘੁੰਮ ਕੇ ਆਈ ਹਾਂ ਫੋਟੋਗ੍ਰਾਫੀ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਨੂੰ ਫੋਟੋਗ੍ਰਾਫੀ ਕਰਨਾ ਬਹੁਤ ਵਧੀਆ ਹੈ